ਪੰਜਾਬ ਜਿਹੜੇ ਪ੍ਰਮੁੱਖ ਤੌਰ 'ਤੇ ਉਹ ਆਪਣੇ ਆਪ ਦੇ ਅੰਦਰ ਕੋਈ ਕਬਾਇਲੀ ਖੇਤਰ ਨਹੀਂ ਹੈ ਪਰ ਹਾਂ ਆਪਾਂ ਕੁਝ ਕਬੀਲਾਈ ਪਰੰਪਰਾਵਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਉਹ ਹਜੇ ਵੀ ਦੇਖ ਸਕਦੇ ਹਾਂ ਜਿੱਦਾਂ ਗੱਡੀਆਂ ਵਾਲੇ ਹੋ ਗਏ ਇਹ ਜਿਹਨਾਂ ਨੂੰ ਆਪਾਂ ਅੰਗਰੇਜ਼ੀ ਵਿੱਚ ਨੂਮੈੜਸ ਕਹਿ ਦਿੰਦੇ ਹਾਂ ਉਹ ਹੁੰਦੇ ਹਨ ਅਤੇ ਸਦਾ ਚਾਲੇ 'ਤੇ ਰਹਿੰਦੇ ਹਨ ਅਤੇ ਆਪਣੇ ਨਾਲ ਟਾਂਗੇ ਗੱਡੇ ਉਹ ਸਭ ਸਦਾ ਰੱਖਦੇ ਹਨ ਅਤੇ ਇਹ ਕਦੇ ਵੀ ਇੱਕ ਥਾਂ 'ਤੇ ਟਿੱਕੇ ਕੇ ਨਹੀਂ ਰਹਿੰਦੇ ਦੂਜੇ ਆਪਾਂ ਦੇਖ ਸਕਦੇ ਹਾਂ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਇਹ ਘੋੜਿਆਂ 'ਤੇ ਸਵਾਰ ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਦੇ ਜੱਥੇ ਹੁੰਦੇ ਹਨ ਜਿਹੜੇ ਕਿ ਅਲੱਗ ਜਿਹੜੀ ਸੋਸਾਇਟੀ ਹੈ ਇਹ ਜਿਹੜੀ ਆਮ ਜਿਹੜੇ ਆਮ ਸੰਸਾਰ ਹੈ ਲੋਕਾਂ ਦੇ ਵਿੱਚ ਹੁੰਦਾ ਉਹ ਤੋਂ ਅਲੱਗ ਆਪਣੇ ਆਪ ਵਿਚਰਦੇ ਰਹਿੰਦੇ ਹਨ ਅਲੱਗ ਅਲੱਗ ਸਥਾਨਾਂ 'ਤੇ ਅਤੇ ਹਮੇਸ਼ਾਂ ਅਲੱਗ ਅਲੱਗ ਜਗ੍ਹਾ ਟਿਕਾ ਕਰਦੇ ਹਨ ਕੋਈ ਪੱਕੇ ਸਥਾਨ 'ਤੇ ਇਹ ਵੀ ਨਹੀਂ ਜੁੜਦੇ ਜਿਸ ਕਾਰਨ ਕਿਉਂਕਿ ਇੱਦਾਂ ਦੇ ਇਹ ਦੋ ਕਬੀਲੇ ਜਿਹੜੇ ਹਨ ਕਬੀਲਿਆਂ ਵਾਂਗ ਹਨ ਕਬੀਲੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਇੱਕ ਥਾਂ 'ਤੇ ਟਿਕ ਕੇ ਨਹੀਂ ਰਹਿੰਦੇ ਉਸ ਕਾਰਨ ਇਹ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਭਾਵੇਂ ਉਹ ਸਿਹਤ ਦੀਆਂ ਹੋਣ ਸਿੱਖਿਆ ਦੀਆਂ ਹੋਣ ਸੰਭਾਲ ਦੀਆਂ ਹੋਣ ਜਿਹੜੀਆਂ ਬੁਨਿਆਦੀ ਲੋੜਾਂ ਨਾਲ ਜੁੜੀਆਂ ਹੁੰਦੀਆਂ ਹਨ ਉਹਨਾਂ ਨੂੰ ਉਹ ਇਹਨਾਂ ਨੂੰ ਸੌਖੀਆਂ ਉਪਲਬਧ ਨਹੀਂ ਹੁੰਦੀਆਂ ਇੱਕ ਤਾਂ ਇਸ ਕਾਰਨ ਕਿਉਂਕਿ ਧਨ ਰਾਸ਼ੀ ਇਹਨਾਂ ਕੋਲ ਘੱਟ ਹੁੰਦੀ ਹੈ ਦੂਜਾ ਇਕ ਥਾਂ 'ਤੇ ਟਿਕ ਕੇ ਨਹੀਂ ਰਹਿੰਦੇ ਉਸ ਕਾਰਨ ਇਹ ਜਿਹੜੇ ਜਿਹੜੀਆਂ ਮਹਿੰਗੀਆਂ ਅਤੇ ਹੋਰ ਸਰਕਾਰੀ ਵੀ ਜਿਹੜੀਆਂ ਸਹੂਲਤਾਂ ਹੁੰਦੀਆਂ ਹਨ ਉਹ ਸੌਖੇ ਤਰੀਕੇ ਨਾਲ ਉਹਨਾਂ ਨੂੰ ਇਹ ਲੈ ਨਹੀਂ ਪਾਉਂਦੇ ਇਸ ਦਾ ਜਿਹੜੀਆਂ ਇਹ ਮੁੱਖ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੀ ਹੈ ਪਰ ਅਗਰ ਕਬੀਲਾਈ ਤੌਰ 'ਤੇ ਦੇਖਿਆ ਜਾਵੇ ਅਗਰ ਇਹਨਾਂ ਦੇ ਮਤਲਬ ਆਪਣੇ ਸੱਭਿਆਚਾਰ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇਹ 'ਚ ਜ਼ਿਆਦਾ ਪਸੰਦ ਵੀ ਨਹੀਂ ਕਰਦੇ ਜਿਹੜਾ ਸਰਕਾਰੀ ਜਿਹੜਾ ਸਿੱਖਿਆ ਕੇਂਦਰ ਭਾਗ ਲੈਣਾ ਪਰ ਹਾਂ ਜਿਹੜੀਆਂ ਬਿਮਾਰੀ ਦੀਆਂ ਸਿਹਤ ਸੰਭਾਲ ਦੀਆਂ ਜਿਹੜੀਆਂ ਸਹੂਲਤਾਂ ਹਨ ਉਹ ਫਿਰ ਵੀ ਕੁਝ ਹੱਦ ਤੱਕ ਉਪਲਬਧ ਹੋ ਜਾਂਦੀਆਂ ਹਨ ਸੌਖੀਆਂ ਅਤੇ ਬਾਕੀ ਵੀ ਆਯੁਰਵੈਦਿਕ ਡਾਕਟਰ ਵਗੈਰਾ ਪੰਜਾਬ ਦੇ ਅੰਦਰ ਵੱਖ ਵੱਖ ਥਾਵਾਂ 'ਤੇ ਹਨ ਜੋ ਇੱਕ ਰੁਪਇਆ ਯਾਂ ਦੋ ਰੁਪਏ ਦੀ ਪਰਚੀ ਕੱਟ ਕੇ ਅਕਸਰ ਇਲਾਜ ਕਰ ਦਿੰਦੇ ਹਨ ਹਰ ਤਰੀਕੇ ਦਾ ਜੋ ਕਿ ਕਾਫੀ ਹੱਦ ਤੱਕ ਸਫਲ ਠਹਿਰਦਾ ਹੈ

ਸਿਹਤ ਸੰਭਾਲ ਤਾਂ ਫਿਰ ਵੀ ਠੀਕ ਹੈ ਸਿੱਖਿਆ ਜਿਹੜੀ ਹੈ ਉਹ ਮੁੱਖ ਚੁਣੌਤੀ ਅਜਿਹੇ ਕਬੀਲਾਈ ਪਰੰਪਰਾਗਤ ਜਿਹੜੇ ਲੋਕ ਹਨ ਜਾਂ ਜਾਂ ਇਕੱਠ ਹਨ ਉਹਨਾਂ ਲਈ ਇਹ ਐਜ਼ ਆ ਚੁਣੌਤੀ ਖੜ੍ਹੀ ਹੋ ਸਕਦੀ ਹੈ